ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਰਵਾਇਤੀ ਖੇਡਾਂ ਹਨ ਜਿਵੇਂ ਗੁੱਲੀ ਡੰਡਾ ਕਬੱਡੀ ਰੋੜੇ ਪੀਚੋ ਆਦਿ ਇਹੋ ਜਿਹੇ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜੋ ਪੁਰਾਣੇ ਸਮਿਆਂ ਵਿੱਚ ਵੀ ਲੋਕ ਬਹੁਤ ਚਾਵਾਂ ਨਾਲ ਖੇਡਦੇ ਸੀ ਜਿਵੇਂ ਅਸੀਂ ਗੁੱਲੀ ਡੰਡਾ ਗੁੱਲੀ ਡੰਡੇ ਵਿੱਚ ਅਸੀਂ ਧਰਤੀ ਵਿੱਚ ਇੱਕ ਛੋਟਾ ਜਿਹਾ ਟੋਆ ਪੱਟ ਕੇ ਉਸ ਉੱਤੇ ਇੱਕ ਲੱਕੜ ਦੀ ਛੋਟੀ ਜਿਹੀ ਗੁੱਲੀ ਰੱਖ ਕੇ ਅਤੇ ਇੱਕ ਡੰਡਾ ਲੈ ਕੇ ਉਸਨੂੰ ਉੱਪਰ ਤੱਕ ਪੂਰੇ ਜ਼ੋਰ ਨਾਲ ਮਾਰ ਕੇ ਉਸ ਨੂੰ ਦੂਰ ਤੱਕ ਉਛਾਲਿਆ ਜਾਂਦਾ ਹੈ ਅਰੋੜੇ ਉਸਨੂੰ ਤਿੰਨ ਜਾਂ ਚਾਰ ਜਣੇ ਦੁਆਰਾ ਖੇਡਿਆ ਜਾਂਦਾ ਹੈ ਜਿਵੇਂ ਉਸ ਨੂੰ ਧਰਤੀ ਦੇ ਉਛਾਲ ਕੇ ਉਹਨੂੰ ਇਹ ਦੂਜੇ ਰੋੜੇ ਨਾਲ ਕੈਚ ਕਰਕੇ ਖੇਡਿਆ ਜਾਂਦਾ ਗਾ ਅਤੇ ਕਬੱਡੀ ਕਬੱਡੀ ਦੋ ਜਣਿਆਂ ਦੀ ਟੀਮ ਹੁੰਦੀ ਹੈਗੀ ਇ ਇ ਉਹਨਾਂ ਵਿਚਾਲੇ ਇੱਕ ਲਾਈਨ ਖਿੱਚੀ ਜਾਂਦੀ ਹੈਗੀ ਅਤੇ ਇੱਕ ਬੰਦਾ ਰੇਡ ਪਾ ਕੇ ਦੂਜੀ ਟੀਮ ਦੇ ਹੱਥ ਦੂਜੀ ਟੀਮ ਦੇ ਮੈਂਬਰ ਦੇ ਹੱਥ ਲਗਾ ਕੇ ਵਾਪਸ ਜਾਣ ਲੱਗਦਾ ਜੇਕਰ ਉਹ ਆਦਮੀ ਉਹਨੂੰ ਫੜ ਲੈਂਦਾ ਤਾਂ ਉਹ ਹਾਰ ਜਾਂਦਾ ਅਤੇ ਜੇਕਰ ਜੇ ਉਹ ਲਾਈਨ ਨੂੰ ਟੱਪ ਜਾਂਦਾ ਗਾ ਤਾਂ ਉਹ ਜਿੱਤ ਜਾਂਦਾ ਗਾ ਅਤੇ ਧੰਨਵਾਦ